ਹਾਂਜੀ ਅਸੀਂ ਬਿਜਲੀ ਦੇ ਖ਼ਤਰਿਆਂ ਤੋਂ ਜਾਣੂ ਹਾਂ ਬਿਜਲੀ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਘਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਬਿਜਲੀ ਦ ਦੇ ਨਾਲ ਚੱਲਦੀਆਂ ਹਨ ਪਰ ਬਿਜਲੀ ਦੇ ਬਹੁਤ ਸਾਰੇ ਬਹੁਤ ਸਾਰੇ ਨੁਕਸਾਨ ਵੀ ਹਨ ਕਿ ਜਿਵੇਂ ਆਪਾਂ ਕਦੇ ਜੁੱਤੀ ਨਾ ਪਾਈ ਹੋਵੇ ਜਾਂ ਆਪਾਂ ਗਿੱਲੇ ਹੋਈਏ ਅਤੇ ਫਿਰ ਆਪਾਂ ਬਿਜਲੀ ਨੂੰ ਦੇ ਕਿਸੇ ਵੀ ਕਿ ਕਿਸੇ ਵੀ ਸਵ ਸਵਿੱਚ ਵਗੈਰਾ ਨੂੰ ਹੱਥ ਲਾਈਏ ਤਾਂ ਸਾਨੂੰ ਕਰੰਟ ਲੱਗ ਸਕਦਾ ਹੈ ਜਾਂ ਜਿਵੇਂ ਵੀ ਜਦੋਂ ਵੀ ਕੋਈ ਕਿ ਕੋਈ ਵੀ ਹੜ੍ਹ ਵਗੈਰਾ ਵਾਲਾ ਸੀ ਦੀ ਹਾਲਾਤ ਹੋਣ ਤਾਂ ਉਸ ਟਾਇਮ 'ਤੇ ਵੀ ਜੇ ਅਸੀਂ ਹੱਥ ਲਗਾਈਏ ਜਾਂ ਜੇ ਕੋਈ ਵੀ ਖੰਭੇ ਵਗੈਰਾ ਹਨ ਜਿਵੇਂ ਉਹ ਗਿਰ ਜਾਂਦੇ ਆ ਹ ਗਿਰ ਜਾਂਦੇ ਹਨ ਤਾਂ ਉਸ ਟਾਇਮ 'ਤੇ ਕਿਸੇ ਨੂੰ ਵੀ ਕਰੰਟ ਲੱਗਣ ਦੀ ਪੂਰਾ ਪੂਰਾ ਖ਼ਤਰਾ ਹੁੰਦਾ ਹੈ ਜਿਵੇਂ ਕਿ ਹੁਣ ਹਾਲ ਹੀ ਕਿ ਰੋਪੜ ਦੇ ਵਿੱਚ ਹੜ੍ਹ ਆਇਆ ਹੈ ਅਤੇ ਬ ਬਹੁਤ ਸਾਰੇ ਖੰਭੇ ਵਗੈਰਾ ਗਿਰ ਗਏ ਹਨ ਟਰਾਂਸਫਾਰਮਰ ਵਗੈਰਾ ਖ਼ਰਾਬ ਹੋ ਗਏ ਹਨ ਅਤੇ ਜੇ ਕੋਈ ਵੀ ਬੱਚਾ ਜਾਂ ਕੋਈ ਵੀ ਲਾਵਾਰਿਸ ਜਾਨਵਰ ਉਨ੍ਹਾਂ ਦੇ ਨਾਲ ਲੱਗ ਜਾਂਦਾ ਹੈ ਤਾਂ ਉਹਨਾਂ ਨੂੰ ਕਰੰਟ ਲੱਗ ਸਕਦਾ ਹੈ ਤਾਂ ਅਜਿਹੀਆਂ ਅਜਿਹੇ ਹਾਲਾਤਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਅਤੇ ਸਾਨੂੰ ਇਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਵੀ ਜਦੋਂ ਵੀ ਕੋਈ ਵੀ ਅਸੀਂ ਬਿਜਲੀ ਵਾਲਾ ਕੰਮ ਕਰਨਾ ਹੋਵੇ ਤਾਂ ਪੈਰਾਂ ਦੇ ਵਿੱਚ ਜੁੱਤੀ ਪਾਈ ਹੋਵੇ ਅਤੇ ਅਸੀਂ ਗਿੱਲੇ ਹੋ ਕੇ ਬਿਜਲੀ ਵਾਲੀ ਜਗ੍ਹਾ ਨਾ ਬਿਜਲੀ ਦੇ ਆਸ ਪਾਸ ਨਾ ਜਾਈਏ ਅਤੇ ਜਦੋਂ ਵੀ ਹੜ੍ਹ ਵਗੈਰਾ ਵਾਲਾ ਸਿਚੁਏਸ਼ਨ ਹੋਵੇ ਤਾਂ ਉਸ ਟਾਇਮ 'ਤੇ ਅਸੀਂ ਖੰਭਿਆਂ ਵਗੈਰਾ ਤੋਂ ਟਰਾਂਸਫਾਰਮਰ ਵਗੈਰਾ ਤੋਂ ਦੂਰ ਹੋ ਕੇ ਲੰਘੀਏ ਅਤੇ ਕਦੇ ਵੀ ਜਿਵੇਂ ਛੋਟੇ ਬੱਚੇ ਸਵਿੱਚ ਵਗੈਰਾ ਦੇ ਵਿੱਚ ਹੱਥ ਪਾ ਲੈਂਦੇ ਹਨ ਤਾਂ ਉਹਨਾਂ ਦਾ ਧਿਆਨ ਰੱਖੀਏ ਕਿ ਉਹ ਸਵਿੱਚ ਵਗੈਰਾ ਦੇ ਵਿੱਚ ਹੱਥ ਨਾ ਪਾਉਣ ਇਸ ਤਰੀਕੇ ਦੇ ਨਾਲ ਅਸੀਂ ਬਿਜਲੀ ਦੇ ਖ਼ਤਰਿਆਂ ਤੋਂ ਬੱਚ ਸਕਦੇ ਹਾਂ